ਹੈਲੋ ਹਾਂਜੀ ਹਾਂਜੀ ਗੁੱਡ ਮੋਰਨਿੰਗ ਸਰ ਹਾਂਜੀ ਸਰ ਜੀ ਹੁਕਮ ਠੀਕ ਠੀਕ ਹੈ ਸਰ ਤੁਸੀਂ ਦੱਸੋ ਜੀ ਕ੍ਰਿਪਾ ਜੀ ਬਾਬੇ ਦੀ ਅੱਛਾ ਜੀ ਠੀਕ ਹੈ ਜੀ ਮੈਂ ਦੱਸ ਦਿੰਦਾ ਸਰ ਜੀ ਸਰ ਇੱਕ ਤਾਂ ਸਰ ਆਪਣੇ ਪੰਜਾਬ 'ਚ ਕਾਫ਼ੀ ਥਾਵਾਂ ਆ ਜਿੱਦਾਂ ਕੀ ਪਹਿਲਾਂ ਤਾਂ ਆਪਣੇ ਹੈਗਾ ਹੈ ਕੀ ਗੋਲਡਨ ਟੈਪਲ ਅੰਮ੍ਰਿਤਸਰ ਉਹ ਤਾ ਉਹ ਤਾ ਉੱਦਾਂ ਹੀ ਬਹੁਤ ਮਸ਼ਹੂਰ ਆ ਕਿਉਂਕਿ ਔਲ ਓਵਰ ਦ ਵਲਡ ਲੋਕੀ ਫੋਰਨਰ 'ਚੋਂ ਵੀ ਦੇਖਣ ਆਉਂਦੇ ਸਗੋਂ ਇਤਿਹਾਸਕ ਜਗ੍ਹਾ ਹੈ ਫਿਰ ਆਪਣਾ ਦੂਜੇ ਨੰਬਰ 'ਤੇ ਸਰ ਹੈਗਾ ਖਟਕੜ ਕਲਾਂ ਹੈਗਾ ਜੀ ਸ਼ਹੀਦ ਭਗਤ ਸਿੰਘ ਜੀ ਦਾ ਘਰ ਓ ਮਿਊਜ਼ੀਅਮ ਹਾਂਜੀ ਸਰਦਾਰ ਸਰਦਾਰ ਸ਼ਹੀਦ ਭਗਤ ਸਿੰਘ ਜੀ ਆਪਣੇ ਫਰੀਡਮ ਫਾਈਟਰ ਉਹਨਾਂ ਦਾ ਜੀ ਠੀਕ ਹੀ ਜੀ ਫਿਰ ਆਪਣੇ ਫਿਰ ਸਰਹਿੰਦ ਗੁਰਦੁਆਰਾ ਵੀ ਹੈਗੇ ਜੀ ਹਾਂਜੀ ਉਹ ਵੀ ਬਹੁਤ ਮਸ਼ਹੂਰ ਹੈ ਜੀ ਫਿਰ ਆਪਣੇ ਹੋਰ ਕਈ ਥਾਵਾਂ ਹੈਗੀਆਂ ਜਿੱਦਾਂ ਕੀ ਚੰਡੀਗੜ੍ਹ ਸੁਖਨਾ ਲੇਕ ਵੀ ਬਹੁਤ ਮਸ਼ਹੂਰ ਹੈ ਜੀ ਉਹ ਵੀ ਆਪਾਂ ਦੇਖ ਸਕਦੇ ਆ ਹਾਂਜੀ ਅਤੇ ਉਹ ਸਰ ਜੀ ਦੇਖੋ ਤੋਹਾਨੂੰ ਤਾਂ ਇੱਥੋ ਗੱ ਤੁਸੀਂ ਆਉਣਾ ਸਰ ਕਿੱਥੋ ਆ ਸਰ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਪੰਜਾਬ ਤੋਂ ਠੀਕ ਹੈ ਠੀਕ ਹੈ ਕੋਈ ਨੀ ਮੈਂ ਤੁਸੀਂ ਮੈਂ ਗੱਡੀ ਤੁਹਾਨੂੰ ਔ ਔਰਗਨਾਇਜ਼ ਕਰਾ ਦਵਾਂਗਾ ਮੈਂ ਉੱਦਾਂ ਮੇਰਾ ਫ੍ਰੈਂਡ ਹੈ ਆ ਹਾਂਜੀ ਉਹ ਤੋਂ ਮੈਂ ਗਾਈਡ ਮੈਂ ਗਾਈਡ ਹੈਗਾ ਸਗੋ ਮੈਂ ਤੁਹਾਨੂੰ ਸਾਰੀ ਜਗ੍ਹਾ ਘੁੰਮਾ ਦਵਾਂਗਾ

ਹਾਂਜੀ ਹਾਂਜੀ ਨਾਲ਼ ਚੱਲੂਗਾ ਸਰ ਹਾਂਜੀ ਹਾਂਜੀ ਸਰ ਪੂਰਾ ਸਰ ਦਿਲ ਸਰ ਡੇਲੀ ਦਾ ਸਰ ਸਮਝ ਲਓ ਤਿੰਨ ਹਜ਼ਾਰ ਰੁਪਏ ਖ਼ਰਚਾ ਹੈ ਡੇਲੀ ਦਾ ਸਰ ਹਾਂਜੀ ਠੀਕ ਹੈ ਓਕੇ ਸਰ ਜੀ ਓਕੇ